ਹਾਂਜੀ ਅਸੀਂ ਵਾਈਫਾਈ ਜਾਂ ਮੋਬਾਇਲ ਡਾਟਾ ਦੀ ਵਰਤੋਂ ਕਰਦੇ ਹਾਂ ਕਿਉਂਕਿ ਇਹਨਾਂ ਦੀ ਵਰਤੋਂ ਨਾਲ ਅਸੀਂ ਆਪਣੇ ਜੀਵਨ ਦੇ ਕਈ ਕੰਮ ਨੂੰ ਅਸਾਨ ਬਣਾਉਂਦੇ ਹਾਂ ਜਿਵੇਂ ਕਿ ਅਸੀਂ ਆਪਣੇ ਮੋਬਾਈਲ ਫੋਨ ਵਿੱਚ ਮੋਬਾਈਲ ਡਾਟਾ ਨੂੰ ਓਨ ਕਰਕੇ ਜਾਂ ਵਾਈਫਾਈ ਨਾਲ ਕੁਨੈਕਟ ਕਰਕੇ ਯੂਟਿਊਬ ਉੱਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਰਚ ਕਰਦੇ ਹਾਂ ਅਸੀਂ ਯੂਟੀਊਬ ਉੱਤੇ ਕਈ ਤਰ੍ਹਾਂ ਦੇ ਸੰਗੀਤ ਰੋਮਾਂਚੀ ਕਿਸੇ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਖਬਰਾਂ ਨੂੰ ਸਰਚ ਕਰਦੇ ਹਾਂ ਅਸੀਂ ਆਪਣੇ ਮੋਬਾਈਲ ਫੋਨ ਵਿੱਚ ਗੂਗਲ ਉੱਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਰਚ ਕਰਦੇ ਹਾਂ ਜੋ ਸਾਡੀ ਪੜ੍ਹਾਈ ਵਿੱਚ ਕੰਮ ਆਉਂਦੀਆਂ ਹਨ ਅਸੀਂ ਮੋਬਾਈਲ ਫੋਨ ਉੱਤੇ ਮੋਬਾਇਲ ਡਾਟਾ ਜਾਂ ਵਾਈਫਾਈ ਦੀ ਵਰਤੋਂ ਨਾਲ ਗੂਗਲ ਪੇ ਜਾਂ ਫੋਨਪੇ ਵੀ ਵਰਤੋਂ ਨਾਲ ਇੱਕ ਦੂਜੇ ਨੂੰ ਪੈਸੇ ਦਾ ਆਦਾਨ ਪ੍ਰਦਾਨ ਕਰਦੇ ਹਾਂ ਜੋ ਸਾਡੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਸਾਡੇ ਜੀਵਨ ਵਿੱਚ ਸਮੇਂ ਵੀ ਬੱਚਤ ਵੀ ਕਰਦੇ ਹਨ ਅਸੀਂ ਆਪਣੇ ਮੋਬਾਇਲ ਫੋਨ ਜ ਨੂੰ ਟੀਵੀ ਨਾਲ ਕੁਨੈਕਟ ਕਰਕੇ ਕਈ ਤਰ੍ਹਾਂ ਦੀ ਚੀਜ਼ਾਂ ਟੀਵੀ ਉੱਤੇ ਵੀ ਦੇਖਦੇ ਹਾਂ ਅਸੀਂ ਵਾਈਫਾਈ ਦੀ ਮਦਦ ਨਾਲ ਟੀਵੀ ਉੱਤੇ ਕਈ ਤਰ੍ਹਾਂ ਦੇ ਸਤ ਸਤਿਸੰਗ ਸੰਗੀ ਅਤੇ ਹੋਰ ਤਰ੍ਹਾਂ ਦੀਆਂ ਖਬਰਾਂ ਵੀ ਦੇਖਦੇ ਹਾਂ ਸਾਨੂੰ ਇੱਕ ਦਿਨ ਵਿੱਚ ਮੋਬਾਈਲ ਡਾਟਾ ਡੇਢ ਤੋਂ ਦੋ ਜੀਬੀ ਤੱਕ ਮਿਲਦਾ ਹੈ ਜਿਸ ਵਿੱਚ ਅਸੀਂ ਘੱਟੋ ਘੱਟ ਇੱਕ ਦਿਨ ਵਿੱਚ ਇਕ ਤੋਂ ਦੋ ਜੀਬੀ ਤੱਕ ਡਾਟਾ ਵਰਤਦੇ ਹਾਂ ਸਾਨੂੰ ਨੈਟਵਰਕ ਸਮੱਸਿਆ ਦਾ ਵੀ ਅਨੁਭਵ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਵਾਈਫਾਈ ਜਾਂ ਮੋਬਾਇਲ ਡਾਟਾ ਦੀ ਰੇਂਜ ਉਸ ਥਾਂ ਉੱਤੇ ਨਹੀਂ ਹੁੰਦੀ ਜਿਸ ਸਥਾਨ 'ਤੇ ਅਸੀਂ ਕਈ ਵਾਰ ਚਲੇ ਜਾਂਦੇ ਹਾਂ ਨੈਟਵਰਕ ਸਮੱਸਿਆ ਦਾ ਸਾਨੂੰ ਅਨੁਭਵ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਇਹਨਾਂ ਦੀ ਰੇਂਜ ਬਹੁਤ ਘੱਟ ਹੋ ਜਾਂਦੀ ਹੈ